ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਮੈ ਆਟੋ ਲੈਣਾ ਤਾ ਜੀ ਚੰਡੀਗੜ੍ਹ ਤੱਕ ਜਾਣਾ ਤਾ ਹਾਂਜੀ ਕਿੱਥੇ ਖੜ੍ਹੇ ਤੁਸੀਂ ਕਿੰਨਾਂ ਟਾਈਮ ਲੱਗੇਗਾ ਜੀ ਜਾਣ ਵਾਸਤੇ ਟ੍ਰੈਫਿਕ ਤਾਂ ਨਹੀਂ ਹੁੰਦੀ ਰਸਤੇ ਵਿੱਚ ਕਿੰਨਾਂ ਕਿੰਨਾਂ ਕਿਰਾਇਆ ਲੱਗੇਗਾ ਅਤੇ ਕੋਈ ਹੋਰ ਸਵਾਰੀ ਨਹੀਂ ਬਿਠਾਉਣੀ ਹੈਗੀ ਮੇਰੇ ਪਾਸ ਸਮਾਨ ਬਹੁਤ ਹੈ ਜੀ ਮੈਂ ਸਤਾਰ੍ਹਾਂ ਤੱਕ ਜਾਣਾ ਹੈ ਬੱਸ ਬੱਸ ਸਟੈਂਡ ਤੱਕ ਠੀਕ ਹੈ ਜੀ ਬੱਸ ਸਟੈਂਡ ਦੇ ਅੰਦਰ ਤੱਕ ਉਤਾਰ ਕੇ ਆਉਂਗੇ ਕਿ ਬਾਹਰ ਏ ਮੇਰੇ ਪਾਸ ਸਮਾਨ ਜ਼ਿਆਦਾ ਹੈ ਨਾ ਅੰਦਰ ਲੈ ਕੇ ਜਾਣਾ ਔਖਾ ਏ ਫਿਰ ਮੈਨੂੰ ਠੀਕ ਹੈ ਜੀ

ਠੀਕ ਹੈ ਮੈਨੂੰ ਉਰੇ ਲੱਗ ਜਾਣਾ ਜੀ ਵੀਹ ਕੁ ਮਿੰਟ ਲੱਗ ਜਾਣੇ ਜੀ ਤੁਹਾਡਾ ਇਸ ਇਸ ਨੰਬਰ ਉੱਪਰ ਵਟਸਐਪ ਚੱਲਦਾ ਹੈ ਮੈਂ ਲੋਕੇਸ਼ਨ ਭੇਜ ਦੂੰਗਾ ਤੁਸੀਂ ਉੱਥੇ ਤੋਂ ਪਿਕ ਕਰ ਲਿਓ ਮੈਨੂੰ ਨਾਲੇ ਟੈਮ ਗੈਲ ਆ ਜਿਓ ਜੀ ਉੱਥੇ ਫਿਰ ਮੈਨੂੰ ਵੇਟ ਮੈਨੂੰ ਵੇਟ ਨਾ ਕਰਨੀ ਪਵੇ ਟੈਮ ਨੂੰ ਬਹੁਤ ਘੱਟ ਹੈ ਮੇਰੇ ਪਾ ਉ ਉੱਤੇ ਜਾ ਕੇ ਮੈਂ ਮੀਟਿੰਗ ਅਟੈਂਡ ਕਰਨੀ ਹੈ ਆਪਣੀ ਚਲੋ ਠੀਕ ਹੈ ਵੀਰ ਠੀਕ ਹੈ ਜੀ